ਹਾਂਜੀ ਸਕੂਲਾਂ ਵਿੱਚ ਕੋਈ ਪਾਠਕ੍ਰਮ ਤੋਂ ਬਾਹਰ ਦੀਆਂ ਵੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਹੋ ਰਹੀਆਂ ਹਨ ਜਿਵੇਂ ਕਿ ਵੱਖ ਵੱਖ ਤਰ੍ਹਾਂ ਦੇ ਖੇਡਾਂ ਅਤੇ ਉਹਨਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਜਿਨ੍ਹਾਂ ਜਿਨ੍ਹਾਂ ਵਿੱਚ ਬੱਚਿਆਂ ਦਾ ਬਹੁਤ ਹੀ ਰੁਚੀ ਮੰਨੀ ਜਾਂਦੀ ਹੈ ਇਹ ਖੇਡਾਂ ਦੇ ਨਾਲ ਨਾਲ ਬੱਚੇ ਆਪਣੇ ਆਪਣਾ ਸਰੀਰ ਵੀ ਤੰਦਰੁਸਤ ਰੱਖਦੇ ਹਨ ਅਤੇ ਬਿਮਾਰੀਆਂ ਤੋਂ ਦੂਰ ਰਹਿੰਦੇ ਹਨ ਜਿਨ੍ਹਾਂ ਸਕੂਲਾਂ ਵਿੱਚ ਇਹ ਖੇਡਾਂ ਕਰਵਾਈਆਂ ਜਾਂਦੀਆਂ ਹਨ ਉਹਨਾਂ ਸਕੂਲਾਂ ਵਿੱਚ ਬੱਚ ਉਹਨਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਬੱਚੇ ਬਹੁਤ ਹੀ ਖੁਸ਼ੀ ਨਾਲ ਇਹਨਾਂ ਟੀਮਾਂ ਵਿੱਚ ਤਰੀਕੇ ਨਾਲ ਭਾਗ ਲੈਂਦੇ ਹਨ ਜਿਵੇਂ ਕਿ ਸਕੂਲਾਂ ਵਿੱਚ ਇੰਟਰ ਕੋਲਜ ਅਤੇ ਇੰਟਰ ਕਲਾਸ ਇੰਟਰ ਡਿਪਾਰਟਮੈਂਟ ਵੀ ਇੰਟਰ ਡਿਪਾਰਟਮੈਂਟ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਜਿਨ੍ਹਾਂ ਵਿੱਚ ਇਨਾਮ ਦੇ ਤੌਰ 'ਤੇ ਉਹਨਾਂ ਨੂੰ ਹੈਡ ਵਾਈਸ ਪ੍ਰੈਜੀਡੈਂਟ 'ਚ ਚੁਣਿਆ ਜਾਂਦਾ ਹੈ ਕਈ ਸਕੂਲਾਂ ਦੇ ਕਪਤਾਨਾਂ ਨੂੰ ਭਾਰੀ ਗਿਣਤੀ ਵਿੱਚ ਪੈਸੇ ਵੀ ਦਿੱਤੇ ਜਾਂਦੇ ਹਨ ਇਹ ਇਹਨਾਂ ਇਹਨਾਂ ਖੇਡਾਂ ਨੂੰ ਦੇਖ ਕੇ ਬੱਚੇ ਅ ਪੜ੍ਹਾਈ ਦੇ ਨਾਲ ਨਾਲ ਆਪਣੇ ਆਪ ਨੂੰ ਤੰਦ ਤੰਦਰੁਸਤ ਰੱਖਦੇ ਹਨ ਬੱਚੇ ਬਹੁਤ ਹੀ ਵੱਧ ਗਿਣਤੀ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਪੂਰੇ ਜੋਸ਼ ਉਲਾਸ ਨਾਲ ਆਪਣਾ ਆਪਣਾ ਜੋਸ਼ ਦਿਖਾਉਂਦੇ ਹਨ ਜਿਨ੍ਹਾਂ ਗਿਣਤੀਆਂ ਨੂੰ ਦੇਖ ਕੇ ਇਹ ਬੱਚੇ ਜਾ ਰਹੇ ਹਨ ਇੱਦਾਂ ਹੀ ਹਨ ਸਾਡੇ ਪੰਜਾਬ ਦਾ ਨੌਜਵਾਨ ਭਵਿੱਖ ਬਹੁਤ ਹੀ ਵਧੀਆ ਲੱਗਦਾ ਹੈ ਜਿਨ੍ਹਾਂ ਕਰਕੇ ਸਕੂਲਾਂ ਨੂੰ ਅਸੀਂ ਬਹੁਤ ਹੀ ਵਧੀਆ ਮਨ ਮੰਨਦੇ ਹਾਂ ਧੰਨਵਾਦ